ਸਲਾਨਾ ਜੋੜ ਮੇਲਾ ਫਤਿਹਗੜ੍ਹ ਸਾਹਿਬ ਪੋਹ ਦੇ ਮਹੀਨੇ ਵਿੱਚ ਲੱਗਦਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੇ ਜਿਨ੍ਹਾਂ ਦੀ ਉਮਰ ਸੱਤ ਅਤੇ ਨੌ ਸਾਲ ਦੀ ਸੀ ਉਹਨਾਂ ਦੀ ਯਾਦ ਵਿੱਚ ਲੱਗਦਾ ਹੈ ਇਹ ਸਾਨੂੰ ਸਿਰ ਉੱਚਾ ਕਰਕੇ ਜਿਊਣ ਦੀ ਮਤਲਬ ਹੌਂਸਲਾ ਆਉਂਦਾ ਬੰਦੇ ਦੇ ਵਿੱਚ ਬਈ ਕਿਸ ਤਰ੍ਹਾਂ ਸ਼ਾਨ ਦੇ ਨਾਲ ਜਿਊਣਾ ਅਤੇ ਵੱਡੇ ਸਾਹਿਬਜ਼ਾਦੇ ਆ ਜਿਹੜੇ ਉਹਨਾਂ ਦਾ ਸਲਾਨਾ ਜੋੜ ਮੇਲਾ ਚਮਕੌਰ ਸਾਹਿਬ ਵਿੱਚ ਲੱਗਦਾ ਉਹਨਾਂ ਨੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਸੀ ਅਸੀਂ ਬਚਪਨ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਇਹ ਸਲਾਨਾ ਜੋੜ ਮੇਲਾ ਛੋਟੇ ਛੋਟੇ ਹੁੰਦੇ ਦੇਖਣ ਜਾਂਦੇ ਸੀ ਜੋ ਕਿ ਉਹ ਬਚਪਨ ਦੀਆਂ ਯਾਦਾਂ ਹੁਣ ਵੀ ਮਨ ਦੇ ਵਿੱਚ ਆਪਣਾ ਘਰ ਬਣਾ ਕੇ ਬੈਠੀਆਂ ਨੇ